ਮੈਂ ਚਾਹੁੰਦੀ ਹਾਂ ਕਿ ਸਿਹਤ ਵਿੱਚ ਸਿਹਤ ਸੰਭਾਲ ਦੇ ਵਿੱਚ ਅਤੇ ਆਵਾਜਾਈ ਦੇ ਵਿੱਚ ਸਿੱਖਿਆ ਦੇ ਵਿੱਚ ਅਤੇ ਹੋਰ ਬੁਨਿਆਦੀ ਲੋੜਾਂ ਨੂੰ ਦੇਖਦੇ ਹੋਏ ਮੈਂ ਚਾਹੁੰਦੀ ਹਾਂ ਇਹਨਾਂ ਸਾਰਿਆਂ ਦੇ ਵਿੱਚ ਜਿਹੜੇ ਕੰਮ ਕਰਦੇ ਲੋਕ ਨੇ ਉਹਨਾਂ ਨੂੰ ਪਰਫੋਰਮੈਂਸ ਦੇ ਬੇਸ ਦੇ ਉੱਤੇ ਉਹਨਾਂ ਨੂੰ ਇੰਕਰੀਮੈਂਟ ਦਿੱਤਾ ਜਾਵੇ ਤਾਂ ਕਿ ਜੋ ਹੈ ਹਰ ਇੱਕ ਬੰਦਾ ਹਰ ਇੱਕ ਕੰਮ ਨੂੰ ਵਧੀਆ ਤਰੀਕੇ ਨਾਲ ਕਰੇ ਤੇ ਜਿਹੜੀ ਪਬਲਿਕ ਡੀਲਿੰਗ ਹੈ ਉਹ ਵੀ ਬਹੁਤ ਵਧੀਆ ਤਰੀਕੇ ਨਾਲ ਕਰੇ ਜਿਵੇਂ ਇੱਕ ਟੀਚਰ ਹੈ ਇੱਕ ਅਧਿਆਪਕ ਹੈ ਉਸ ਦਾ ਕੰਮ ਹੈ ਬੱਚਿਆਂ ਨੂੰ ਸਿੱਖਿਆ ਦੇਣਾ ਜਦਕਿ ਸਰਕਾਰੀ ਅਧਿਆਪਕ ਕੀ ਕਰਦੇ ਹਨ ਕਿ ਉਹ ਆਪਣੇ ਸਿਰਫ ਤਨਖਾਹ ਵਾਸਤੇ ਸਕੂਲ ਆ ਜਾਂਦੇ ਨੇ ਗੱਲਾਂ ਬਾਤਾਂ ਕਰਕੇ ਵਾਪਸ ਮੁੜ ਜਾਂਦੇ ਨੇ ਇਸੇ ਕਰਕੇ ਜਿਹੜੇ ਲੋਕ ਨੇ ਉਹ ਸਰਕਾਰੀ ਸਕੂਲ ਦੇ ਵਿੱਚ ਨਾ ਪੜ੍ਹਾ ਕੇ ਪ੍ਰਾਈਵੇਟ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪਾ ਰਹੇ ਨੇ ਅਤੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਉਹਨਾਂ ਤੋਂ ਅੱਧੀ ਤਨਖਾਹ ਲੈ ਕੇ ਵੀ ਓਸ ਉਹ ਅਧਿਆਪਕ ਬਹੁਤ ਹੀ ਵਧੀਆ ਬੱਚਿਆਂ ਨੂੰ ਪੜ੍ਹਾਉਂਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਜੇ ਮੈਂ ਵਧੀਆ ਨਹੀਂ ਪੜ੍ਹਾਵਾਂਗਾ ਤਾਂ ਮੈਨੂੰ ਇਸ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਜਦ ਕਿ ਸਰਕਾਰੀ ਅਧਿਆਪਕ ਨੂੰ ਇਹ ਡਰ ਵੀ ਨਹੀਂ ਹੁੰਦਾ ਅਤੇ ਉਸ ਦਾ ਜਿਹੜਾ ਇੰਕਰੀਮੈਂਟ ਹੈ ਉਹ ਟਾਈਮ 'ਤੇ ਲੱਗ ਜਾਣਾ ਘੱਟੋ ਘੱਟ ਇੱਕ ਇੰਕਰੀਮੈਂਟ ਉਸ ਟੀਚਰ ਨੂੰ ਉਦੋਂ ਲੱਗਿਆ ਜਾਵੇ ਜਦੋਂ ਉਸ ਦੀ ਪਰਫੋਰਮੈਂਸ ਵਧੀਆ ਹੋਵੇ ਅਤੇ ਉਹ ਪਰਫੋਰਮੈਂਸ ਜਿਹੜੀ ਹੈ ਬੱਚਿਆਂ ਦੇ ਜਾਂ ਵਿਦਿਆਰਥੀਆਂ ਦੇ ਪੇਰੈਂਟਸ ਤੋਂ ਲਿੱਤੀ ਜਾਵੇ